ਮੇਰਾ ਪਿੰਡ ਪਡਿਆਲਾ ਹੈ ਅਤੇ ਇਹ ਐਸ ਏ ਐਸ ਨਗਰ ਮੋਹਾਲੀ ਵਿੱਚ ਸਥਿਤ ਹੈ ਅਤੇ ਮੇਰਾ ਘਰ ਪਿੰਡ ਦੀ ਫਿਰਨੀ 'ਤੇ ਹੀ ਹੈ ਅਤੇ ਮੇਰੇ ਪਿੰਡ ਵਿੱਚ ਗੁਰੂ ਘਰ ਜੋ ਕਿ ਹਰ ਰੋਜ਼ ਪੀ ਜੀ ਆਈ ਲਈ ਉੱਥੋਂ ਲੰਗਰ ਜਾਂਦਾ ਹੈ ਅਤੇ ਸੇਵਾ ਲੋਕ ਬਹੁਤ ਹੀ ਸ਼ਰਧਾ ਅਤੇ ਉਹ ਭਾਵਨਾ ਨਾਲ ਕਰਦੇ ਹਨ ਅਤੇ ਮੇਰੇ ਪਿੰਡ ਵਿੱਚ ਪ੍ਰਭ ਆਸਰਾ ਹੈ ਜਿੱਥੇ ਲੋਕਾਂ ਨੂੰ ਬੇਰੁਜ਼ਗਾਰ ਲੋਕਾਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ ਉੱਥੇ ਇਲਾਜ ਕੀਤਾ ਜਾਂਦਾ ਹੈ ਉੱਥੇ ਹਰ ਤਰ੍ਹਾਂ ਦੇ ਲੋਕ ਹਰ ਜਾਤ ਪਾਤ ਦੇ ਲੋਕ ਹਨ ਅਤੇ ਮੇਰੇ ਪਿੰਡ ਵਿੱਚ ਡਿਸਪੈਂਸਰੀ ਹੈ ਜਿੱਥੇ ਡਾਕਟਰ ਬਹੁਤ ਹੀ ਵਧੀਆ ਹੈ ਅਤੇ ਉਹ ਉਸਦੇ ਨਾਲ ਹੀ ਦੋ ਤਿੰਨ ਦੁਕਾਨਾਂ ਅਤੇ ਮੇਰੇ ਪਿੰਡ ਵਿੱਚ ਇੱਕ ਕਾਲਜ ਹੈ ਜੋ ਕਿ ਲੜਕੀਆਂ ਦਾ ਹੈ ਅਤੇ ਉਸਦੇ ਨਾਲ ਹੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਵੀ ਹੈ ਉਸ ਦੇ ਪਿੱਛੇ ਹੀ ਇੱਕ ਬਹੁਤ ਹੀ ਵੱਡਾ ਗਰਾਊਂਡ ਹੈ ਅਤੇ ਪਿੰਡ ਵਿੱਚ ਇੱਕ ਇੱਕ ਤਿੰਨ ਸੌ ਤਿੰਨ ਸੌ ਵੀਹ ਘਰ ਹਨ ਅਤੇ ਹੋਰ ਵੀ ਇੱਥੇ ਫਲੈਟ ਵਗੈਰਾ ਬਣ ਰਹੇ ਹਨ ਅਤੇ ਇਸ ਦੇ ਨਾਲ ਖਰੜ ਤੋਂ ਕੁਰਾਲੀ ਤੱਕ ਮੇਨ ਸੜਕ ਬਣੀ ਹੋਈ ਹੈ ਅਤੇ ਮੇਰੇ ਪਿੰਡ ਤੋਂ ਮੋਰਿੰਡੇ ਤੱਕ ਹਾਈਵੇ ਵੀ ਬਣ ਰਿਹਾ ਹੈ ਅਤੇ ਮੇਰੇ ਪਿੰਡ ਵਿੱਚ ਬਹੁਤ ਹੀ ਸਾਰੇ ਦੋਸਤ ਮਿੱਤਰ ਅਤੇ ਹੋਰ ਵੀ ਅੰਕਲ ਵਗੈਰਾ ਹਨ ਜੋ ਕਿ ਬਹੁਤ ਹੀ ਅੱਛੇ ਅਤੇ ਵਧੀਆ ਘਰਦੇ ਹਨ ਉਹ ਸਾਰੇ ਹੀ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਹਨ ਇੱਥੇ ਹਰੇਕ ਜਾਤ ਦਾ ਹਰੇਕ ਜਾਤ ਦਾ ਵਿਅਕਤੀ ਹੈ ਜੋ ਕਿ ਇੱਕ ਦੂਜੇ ਨਾਲ ਰਲ ਮਿਲ ਕੇ ਅਤੇ ਖੁਸ਼ੀ ਨਾਲ ਰਹਿੰਦਾ ਹੈ ਅਤੇ ਉਹਨਾਂ ਨੇ ਕਈ ਸਾਰੇ ਡੰਗਰ ਖੇਤ ਅਤੇ ਜ਼ਮੀਨਾਂ ਹੋਰ ਜਿੱਥੇ ਉਹ ਫਸਲ ਕਰਦੇ ਹਨ ਖੇਤੀਬਾੜੀ ਕਰਦੇ ਹਨ ਅਤੇ ਪਿੰਡ ਵਿੱਚ ਗੁਰੂ ਘਰ ਵੀ ਹੈ ਜਿੱਥੇ ਹਰ ਰੋਜ਼ ਪਾਠ ਅਤੇ ਉਸਦੇ ਸਾਹਮਣੇ ਹੀ ਇੱਕ ਡੈਅਰੀ ਹੈ ਜਿਸ ਵਿੱਚ ਲੋਕ ਦੁੱਧ ਪਾਉਣ ਆਉਂਦੇ ਹਨ ਅਤੇ ਪਿੰਡ ਵਿੱਚ ਇੱਕ ਟੋਬਾ ਹੈ